ਹਰਿਆ ਭਰਿਆ ਅਤੇ ਸਾਫ਼ ਵਾਤਾਵਰਨ ਦੀ ਰੱਖਿਆ ਲਈ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਵੇ ਜੇ ਰੁੱਖ ਨਹੀਂ ਲਗਾ ਸਕਦਾ ਤਾਂ ਉਹਨਾਂ ਨੂੰ ਪੱਟੋ ਵੀ ਨਾ ਇਹ ਰੁੱਖ ਹੀ ਹਨ ਜੋ ਸਾਨੂੰ ਗਰਮੀ ਵਿੱਚ ਠੰਡੀਆਂ ਛਾਵਾਂ ਦਿੰਦੇ ਹਨ ਜੋ ਕਿ ਇੱਥੋਂ ਵੱਧ ਤੋਂ ਵੱਧ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡੀ ਜ਼ਿੰਦਗੀ ਕੱਖ ਦੀ ਵੀ ਨਹੀਂ ਹੈ ਕਿਉਂਕਿ ਰੁੱਖਾਂ ਤੋਂ ਹੀ ਸਾਨੂੰ ਸਭ ਤੋਂ ਵੱਧ ਔਕਸੀਜਨ ਮਿਲਦੀ ਹੈ ਜੋ ਕਿ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਜਦੋਂ ਵੀ ਅਸੀਂ ਇੱਕ ਵਾਰ ਮੈਂ ਦੱਸਦਾ ਹਾਂ ਕਿ ਮੈਂ ਇਸ ਗਿਆ ਸੀ ਅਪਣੇ ਹੇਮਕੁੰਟ ਸਾਹਿਬ ਹੇਮਕੁੰਟ ਸਾਹਿਬ ਛੱਡੋ ਤੁਸੀਂ ਚੰਡੀਗੜ੍ਹ ਹੀ ਲਗਾ ਲਵੋ ਇੱਥੇ ਦੇ ਸੜਕ ਦੇ ਆਲੇ ਦੁਆਲੇ ਇੰਨੇ ਦਰੱਖਤ ਲੱਗੇ ਵੇ ਹਨ ਜੋ ਕਿ ਰਾਹ ਜਾਂਦੇ ਵਿਅਕਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਹੇਮਕੁੰਟ ਸਾਹਿਬ ਜਾਂਦੇ ਸਮੇਂ ਜਦੋਂ ਆਪਾਂ ਉੱਥੇ ਦੀਆਂ ਪੌੜੀਆਂ ਚੜਦੇ ਹਾਂ ਤਾਂ ਉਹ ਸਾਰਾ ਹੀ ਜੰਗਲ ਹੀ ਜੰਗਲ ਹੈ ਜੋ ਕਿ ਪਹਾੜਾਂ ਅਤੇ ਜੰਗਲਾਂ ਦੇ ਵਿਚਕਾਰ ਆ ਜਾਂਦਾ ਹੈ ਜਿੱਥੋਂ ਦੀ ਹਵਾ ਬਹੁਤ ਸ਼ੁੱਧ ਹੈ